ਹੈਲੋ ਹਾਂਜੀ ਕਾਹਦੇ ਕਿਹੜੇ ਜੀ ਫੁੱਲਾਂ ਦੇ ਜੀ ਅੱਛਾ ਜੀ ਤੁਸੀਂ ਗਮਲਿਆਂ ਸਮੇਤ ਲੈਣੇ ਆ ਜੀ ਕਿ ਬਿਨਾਂ ਗਮਲਿਆਂ ਤੋਂ ਲੈਣੇ ਅਤੇ ਗਮਲੇ ਕਿਹੜੇ ਚਾਹੀਦੇ ਸਰ ਤੁਹਾਨੂੰ ਪਹਿਲਾਂ ਵੀ ਸੀਮੈਂਟ ਵਾਲੇ ਜਾਂ ਦੂਸਰੇ ਪਲਾਸਟਿਕ ਦੇ ਅੱਜਕੱਲ੍ਹ ਮਾਰਬਲ ਦੇ ਵੀ ਚੱਲੇ ਆ ਕੁਛ ਅਤੇ ਇਸ ਹਿਸਾਬ ਨਾਲ ਤਾਂ ਵੈਸੇ ਸੀਮਿਟ ਵਾਲੇ ਹੀ ਸਹੀ ਚਲਦੇ ਆ ਸਾਰੇ ਵਧੀਆ ਚਲਦੇ ਆ ਉਹੀ ਠੀਕ ਆ ਅਤੇ ਜਿਹੜੇ ਉਹ ਬੂਟੇ ਕਿਹੜੇ ਲੈਣੇ ਜੀ ਤੁਸੀਂ ਸਦਾਬਹਾਰ ਫੁੱਲਾਂ ਦੇ ਕੇ ਸੀਜ਼ਨਲ ਸਰ ਫੁੱਲ ਲਵਾਉਣੇ ਅੱਛਾ ਠੀਕ ਹੈ ਜੀ ਕਿੰਨੇ ਕੁ ਸਰ ਲੈਣੇ ਤੁਸੀਂ ਅੱਛਾ ਜੀ ਅਤੇ ਲਵਾਈ ਸਰ ਤੁਸੀਂ ਆਪ ਹੀ ਲਾ ਲਵੋਗੇ ਕਿ ਅਸੀਂ ਆਪ ਲਾ ਕੇ ਦਈਏ ਤੁਹਾਨੂੰ ਅੱਛਾ ਜੀ ਅੱਛਾ ਮਤਲਬ ਸਾਰਾ ਕੁਛ ਵਿੱਚ ਹੀ ਰਖ ਰੱਖ ਕੇ ਫਿਰ ਹੀ ਕਰੀਏ ਹੈ ਨਾ ਜੀ ਠੀ ਕੋਈ ਨਹੀਂ ਸਰ ਤੁਸੀਂ ਦੇਖ ਲਿਓ ਓਕੇ ਸ਼ਾਮ ਨੂੰ ਆ ਜਾਇਓ ਜਾਂ ਫਿਰ ਸ਼ੋਪ 'ਤੇ ਬਹਿ ਕੇ ਆਪਾਂ ਕਰ ਲਵਾਂਗੇ ਡਿਸਕਸ ਨਾਲ ਤੁਸੀਂ ਬੂਟੇ ਵੇਖ ਲਿਓ ਅਤੇ ਨਾਲੇ ਆਪਾਂ ਫਾਈਨਲ ਕਰ ਠੀਕ ਹੈ ਜੀ ਚਲੋ ਠੀਕ ਹੈ ਜੀ ਠੀਕ ਆ ਫਿਰ ਓਕੇ ਜੀ ਬਾਏ ਜੀ ਬਾਏ